ਸਤਿ ਸ਼੍ਰੀ ਅਕਾਲ ਸਰ ਹਾਂਜੀ ਵਧੀਆ ਸਰ ਸਰ ਮੈਂ ਤੁਹਾਡੇ ਤੋਂ ਸੂੂਟ ਸਵਾਇਆ ਸੀ ਸਲ ਸਲਵਾਰ ਸੂਟ ਹਾਂਜੀ ਉਹਦੇ ਸਿੰਪਲ ਸਲਵਾਰ ਸੂਟ ਹੀ ਸਵਾਣਾ ਏ ਹਾਂਜੀ ਸਰ ਫੰਕਸ਼ਨ ਸਾਡੇ ਆਹੀ ਹਫ਼ਤੇ ਤੱਕ ਫੰਕਸ਼ਨ ਹੈ ਹਾਂ ਹਾਂਜੀ

ਹਾਂਜੀ ਨੋਰਮਲ ਸੀਣਾ ਜਿਵੇਂ ਸਾ ਸਾਈਡਾਂ 'ਤੇ ਥੋੜ੍ਹੀ ਕਢ ਲਾਈਨਿੰਗ ਲਗਾ ਪਾਈਪਿੰਗ ਲਗਾਤੀ ਲਾਈਨਿੰਗ ਵਾਲ਼ਾ ਹੋ ਗਿਆ ਥੋੜ੍ਹੀ ਹਾਂਜੀ ਹਾਂਜੀ ਹਾਂਜੀ ਥੋੜ੍ਹਾ ਮਤਲਬ ਸਿੰਪਲ ਹਾਂਜੀ ਹਾਂਜੀ ਨਹੀਂ ਹੁਣ ਟਾਈਮ ਨਹੀਂ ਲੱਗਦਾ ਥੋੜ੍ਹਾ ਬੀਜ਼ੀ ਹੋ ਗਏ ਸੀ ਫਿਰ ਜਿੱਦਾਂ ਹੀ ਫੰਕਸ਼ਨ ਆਇਆ ਉੱਦਾਂ ਹੀ ਤੁਹਾਨੂੰ ਫ਼ੋਨ ਕਰ ਲਿਆ ਹਾਂਜੀ ਹਾਂਜੀ ਮੈਂ ਤੁਹਾਨੂੰ ਵੱਟਸਅੱਪ 'ਤੇ ਸੈਂਡ ਕਰਦੂੰਗੀ ਸਾਰਾ ਲਿਖ ਕੇ ਹਾਂਜੀ ਹਾਂ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਥੋੜ੍ਹੇ ਕੁ ਟਾਈਮ ਤੱਕ ਉਹ ਵੀ ਸਵਾਣੇ ਹੈ ਪਹਿਲਾਂ ਇੱਕ ਸੂਟ ਸਿਲ ਜੇ ਫਿਰ ਉਹ ਵੀ ਕਰਾਂਦਾਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਓਕੇ ਸਭ ਸਭ ਵਧੀਆ ਜੀ ਹਾਂਜੀ ਹਾਂਜੀ ਠੀਕ ਹਾਂਜੀ ਜ਼ਰੂਰ ਜ਼ਰੂਰ ਤੁਹਾਨੂੰ ਦੱਸਾਂਗੇ